ਹੁਣ ਕੁਛ ਸਮੇਂ ਪਹਿਲਾਂ ਹੀ ਸਾਡੇ ਬਾਸਕਿਟਬਾਲ ਦੇ ਸਟੇਟ ਲੈਵਲ ਕੋਂਪੀਟੀਸ਼ਨ ਹੋ ਕੇ ਹਟੇ ਹਨ ਜਿਸ ਦੇ ਲਈ ਸਾਨੂੰ ਬਹੁਤ ਹੀ ਘੱਟ ਸਮਾਂ ਦਿੱਤਾ ਗਿਆ ਸੀ ਸਾਨੂੰ ਦਸ ਦਸ ਕੁ ਦਿਨਾਂ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਸਾਡਾ ਕੰਪੀਟੀਸ਼ਨ ਹੈਗਾ ਹੈ ਮੈਚ ਹੈਗਾ ਹੈ ਰਾਜ ਪੱਧਰੀ ਅਸ ਸਾਡੇ ਉਸ ਤੋਂ ਪਹਿਲਾਂ ਪੇਪਰ ਚੱਲ ਰਹੇ ਸੀਗੇ ਕੋਲੇਜ ਦੇ ਪੇਪਰ ਦੇ ਵਿੱਚ ਵੀ ਅਸੀਂ ਸਾਡੇ ਪੇਪਰ ਲਗਭਗ ਮੈਚ ਤੋਂ ਦਸ ਕੁ ਦਿਨ ਪਹਿਲਾਂ ਹੀ ਖਤਮ ਹੋਏ ਪੇਪਰਾਂ ਦੇ ਵਿੱਚ ਵੀ ਮੈਂ ਪ੍ਰੈਕਟਿਸ ਸਟਾਰਟ ਕਰਤੀ ਸੀ ਕਿਉਂਕਿ ਜਿੱਤਣਾ ਵੀ ਬਹੁਤ ਜ਼ਰੂਰੀ ਸੀਗਾ ਮੈਂ ਸਵੇਰੇ ਅੱਠ ਤੋਂ ਬਾਰਾਂ ਵਜੇ ਤੱਕ ਪੇਪਰ ਦਿੰਦੀ ਸੀ ਉਸ ਤੋਂ ਬਾਅਦ ਚਾਰ ਵਜੇ ਤੱਕ ਘਰ ਜਾ ਕੇ ਪੜ੍ਹਦੀ ਸੀ ਅਤੇ ਚਾਰ ਤੋਂ ਸੱਤ ਵਜੇ ਤੱਕ ਗਰਾਉਂਡ ਜਾ ਕੇ ਆਪਣੀ ਪ੍ਰੈਕਟਿਸ ਕਰਦੀ ਸੀਗੀ ਇਸ ਤਰ੍ਹਾਂ ਮੈਂ ਕਾਫੀ ਦਿਨ ਲੰਘ ਗਏ ਇਸ ਤਰ੍ਹਾਂ ਇਹੀ ਰੋਟੀਨ ਰੱਖੀ ਪੇਪਰਾਂ ਤੋਂ ਬਾਅਦ ਮੈਂ ਲਗਭਗ ਸਵੇਰੇ ਅਤੇ ਸ਼ਾਮ ਦੋਨੋਂ ਟਾਇਮ ਆਪਣੀ ਪ੍ਰੈਕਟਿਸ ਸਟਾਰਟ ਕਰ ਦਿੱਤੀ ਅਤੇ ਰਨਿੰਗ 'ਤੇ ਵੀ ਪੂਰਾ ਜ਼ੋਰ ਦਿੱਤਾ ਕਿਉਂਕਿ ਰਨਿੰਗ ਵੀ ਬਹੁਤ ਜ਼ਰੂਰੀ ਹੁੰਦੀ ਹੈ ਮੈਚ ਦੇ ਵਿੱਚ ਖੇਡਣ ਲਈ ਸਟੈਮੀਨਾ ਚਾਹੀਦਾ ਹੁੰਦਾ ਹੈ ਅਤੇ ਆਪਣੀ ਡਾਇਟ ਵੀ ਪ੍ਰੋਪਰ ਲੈਣੀ ਸ਼ੁਰੂ ਕਰਤੀ ਅੰਤ ਮੈਚ ਦਾ ਦਿਨ ਆਇਆ ਅਤੇ ਮੈਚ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਦਿੱਤਾ ਮੈਂ ਅਤੇ ਆਪਣੀ ਟੀਮ ਨੂੰ ਜਿੱਤ ਪ੍ਰਾਪਤ ਕੀਤੀ ਦਿੱਤੀ